ਆਪ ਮਤਲਬ ਨੱਚਦੇ ਸਮੇਂ ਬਹੁਤ ਤਰੀਕੇ ਦੇ ਜਿਹੜੇ ਪਹਿਰਾਵੇ ਹਨ ਉਹ ਪਹਿਨੇ ਜਾਂਦੇ ਹਨ ਜਿਵੇਂ ਪੰਜਾਬ ਦੇ ਵਿੱਚ ਭੰਗੜੇ ਦੇ ਵਿੱਚ ਜਿਹੜੇ ਮੁੰਡੇ ਹਨ ਉਹ ਤੁਰਲੇ ਵਾਲੀ ਪੱਗ ਬੰਨਦੇ ਹਨ ਗਲ ਵਿੱਚ ਕੈਂਠਾ ਪਾਉਂਦੇ ਹਨ ਕੁੜਤਾ ਪਾਉਂਦੇ ਹਨ ਅਤੇ ਥੱਲੇ ਚਾਦਰਾਂ ਅਤੇ ਉਸਦੇ ਥੱਲੇ ਜੁੱਤੀ ਪਾਉਂਦੇ ਹਨ ਅਤੇ ਜੁੱਤੀ ਵੀ ਨੋਕਦਾਰ ਵੀ ਹੁੰਦੀ ਹੈ ਕੁੰਡੀ ਵੀ ਹੁੰਦੀ ਹੈ ਬਹੁਤ ਤਰੀਕੇ ਦੀਆਂ ਜਿਹੜੀਆਂ ਜੁੱਤੀਆਂ ਹਨ ਉਹ ਵੀ ਹੁੰਦੇ ਚਮੜੇ ਦੀ ਜੁੱਤੀ ਵੀ ਹੁੰਦੀ ਹੈ ਨਾਲ ਖੁੰਡਾ ਹੱਥ 'ਚ ਰੱਖਦੇ ਹਨ ਉਸ ਤਰੀਕੇ ਨਾਲ ਕੁੜੀਆਂ ਦੇ ਸਲਵਾਰ ਸੂਟ ਹੁੰਦੇ ਹਨ ਅਤੇ ਜਿਸ ਨਾਲ ਜੁੱਤੀ ਰਹਿੰਦੀ ਹੀ ਹੈ ਅਤੇ ਸਿਰ ਦੇ ਉੱਤੇ ਸੱਗੀ ਫੁੱਲ ਹੋ ਗਿਆ ਟਿੱਕਾ ਹੋ ਗਿਆ ਅਤੇ ਕੋਕਾ ਹੋ ਗਿਆ ਕਾ ਕੰਨਾਂ ਗਲ ਦੇ ਵਿੱਚ ਤਬੀਤੀਆਂ ਹੋ ਗਈਆਂ ਕੈਂਠਾ ਹੋ ਗਿਆ ਅਤੇ ਕੰਨਾਂ ਦੇ ਵਿੱਚ ਪਿੱਪਲ ਪੱਤੀਆਂ ਇਸ ਤਰੀਕੇ ਅਤੇ ਗੁੱਤ ਦੇ ਵਿੱਚ ਪਰਾਂਦੀ ਜਿਹੜੀ ਆ ਉਹ ਜ਼ਰੂਰ ਪੈ ਜਾਂਦੀ ਹੈ ਇਸ ਤਰੀਕੇ ਦੇ ਜਿਹੜੇ ਰਵਾਇਤੀ ਕੱਪੜੇ ਹਨ ਉਹ ਪਹਿਨੇ ਜਾਂਦੇ ਹਨ ਜਿਹਨਾਂ ਬਾਰੇ ਜਿਹਨਾਂ ਬਾਰੇ ਜਾਣਕਾਰੀ ਮੈਨੂੰ ਹੈ ਹੋਰ ਵੀ ਬਹੁਤ ਤਰੀਕੇ ਦੇ ਮੈਨੂੰ ਪਤਾ ਹੈ ਰਵਾਇਤੀ ਕੱਪੜਿਆ ਜਿਹਨਾਂ ਬਾਰੇ ਮੈਨੂੰ ਇੰਨੀ ਜਾਣਕਾਰੀ ਨਹੀਂ ਹੈ